ਮੈਂ ਸਕੂਲ ਵਿੱਚ ਜਿਹੜੀ ਹੈ ਪੇਂਟਿੰਗ ਸਿੱਖੀ ਸੀ ਮੈਨੇ ਦੇਵੀ ਦੇਵਤਾਵਾਂ ਦੀ ਪੇਂਟਿੰਗ ਬਣਾਉਣੀ ਸਿੱਖੀ ਸੀ ਉਹਦਾ ਤਜ਼ਰਬਾ ਮੇਰਾ ਬੜਾ ਚੰਗਾ ਰਿਹਾ ਅਤੇ ਉਹ ਪੇਂਟਿੰਗ ਦਾ ਕੀ ਹੋਇਆ ਕਿ ਮੈਂ ਉਸ ਪੇਂਟਿੰਗ ਨੂੰ ਬਣਾਉਣ 'ਚ ਇੰਨਾ ਅੱਛਾ ਫ਼ੀਲ ਕਰਨ ਲੱਗ ਗਈ ਕਿ ਉਹ ਬਹੁਤ ਅੱਛੀਆਂ ਅੱਛੀਆਂ ਬਣਨੀਆਂ ਸ਼ੁਰੂ ਹੋਈਆਂ ਜਿਹਦੇ ਨਾਲ ਉਹ ਸੇਲ ਵੀ ਕਰਨ ਲਈ ਡਿਮਾਂਡ ਆਉਣ ਲੱਗ ਗਈ ਹੈ ਕਿ ਇਹ ਅਸੀਂ ਜਿਹੜਾ ਹੈਗਾ ਖਰੀਦਣਾ ਚਾਹੁੰਦੇ ਹਾਂ